ਹਾਂਜੀ ਮੈਂ ਆਨਲਾਈਨ ਗੇਮਿੰਗ ਜਾਂ ਟੂਰਨੇਮੈਂਟ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਜਿਵੇਂ ਕਿ ਸਭ ਤੋਂ ਫੇਮਸ ਗੇਮ ਸਭ ਨੂੰ ਪਤਾ ਹੀ ਹੋਵੇਗੀ ਪਬਜੀ ਅਤੇ ਮੈਂ ਪਬਜੀ ਵਿੱਚ ਬਹੁਤ ਹੀ ਵਧੀਆ ਵਧੀਆ ਤਰੀਕੇ ਨਾਲ ਖੇਡਦਾ ਹਾਂ ਜਦ ਵੀ ਮੈਂ ਆਪਣੇ ਕੰਮ ਕਾਰ ਤੋਂ ਫਰੀ ਹੁੰਦਾ ਹਾਂ ਤਾਂ ਟਾਈਮ ਕੱਢ ਕੇ ਇਹ ਗੇਮ ਜ਼ਰੂਰ ਖੇਡਦਾ ਹਾਂ ਮੈਂ ਆਪਣੇ ਪੁਰਾਣੇ ਸਮੇਂ ਵਿੱਚ ਇਸ ਗੇਮ ਵਿੱਚ ਭਾਗ ਲਿਆ ਸੀ ਇਹ ਭਾਗ ਮੈਂ ਸੀ ਆਪਣੇ ਘਰ ਬੈਠੇ ਹੀ ਲਿਆ ਸੀ ਜਿਹਦੇ ਵਿੱਚ ਅਸੀਂ ਚਾਰ ਜਣੇ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਹਾਂ ਅਤੇ ਅਨਿਆਂ ਟੀਮਾਂ ਨਾਲ ਮੁਕਾਬਲਾ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਪੂਰਾ ਤੀਹ ਮਿੰਟ ਦਾ ਸਮਾਂ ਮਿਲਦਾ ਹੈ ਅਤੇ ਅਸੀਂ ਸਾਰੇ ਬੰਦਿਆਂ ਨੂੰ ਖਤਮ ਕਰਨਾ ਹੁੰਦਾ ਹੈ ਅਤੇ ਅੰਤ ਤੱਕ ਆਪ ਬਚਣਾ ਹੁੰਦਾ ਹੈ ਇਹ ਮੁਕਾਬਲੇ ਮੈਂ ਦੋ ਸਾਲ ਪਹਿਲਾਂ ਖੇਡਿਆ ਸੀ ਜਿਹਦਾ ਵਿਨਰ ਵੀ ਮੈਂ ਅਤੇ ਮੇਰੀ ਟੀਮ ਬਣੀ ਸੀ ਜਿਹਦੇ ਕਰਕੇ ਸਾਨੂੰ ਪੂਰੀ ਪੰਜ ਹਜ਼ਾਰ ਇਨਾਮ ਰਾਸ਼ੀ ਵੀ ਮਿਲੀ ਸੀ ਇਹ ਟੂਰਨਾਮੈਂਟ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਏ ਜਾਂਦੇ ਹਨ ਜਿਸ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਇਸ ਗੇਮ ਨੂੰ ਅਸੀਂ ਵੱਧ ਤੋਂ ਵੱਧ ਲੋਕਾਂ ਨਾਲ ਪ੍ਰੇਰਿਤ ਕਰ ਸਕੀਏ ਅਤੇ ਇਹਨਾਂ ਲੋਕਾਂ ਵਿੱਚ ਇਹਦਾ ਗਿਆਨ ਵਾਧਾ ਕਰ ਸਕੀਏ ਇਹਦੇ ਨਾਲ ਨਾਲ ਮੈਂ ਬਹੁਤ ਖੇਡੀ ਹੈ ਇਹਦੇ ਟੂਰਨਾਮੈਂਟ ਤਾਂ ਚੰਡੀਗੜ੍ਹ ਵਿੱਚ ਹੁੰਦੇ ਹਨ ਜਿਹਦੇ ਜਿਹਦੇ ਨਾਲ ਸਾਨੂੰ ਪਹਿਲਾਂ ਪ੍ਰੀ ਰਜਿਸਟਰੇਸ਼ਨ ਕਰਾਉਣੀ ਪੈਂਦੀ ਹੈ ਅਤੇ ਇਨਾਮ ਵੀ ਕਾਫੀ ਲੱਖਾਂ ਗਿਣਤੀ ਵਿੱਚ ਹੁੰਦੇ ਹਨ ਜਿਹਦੇ ਨਾਲ ਜਿਹੜਾ ਬੰਦਾ ਪਹਿਲੇ ਨੰਬਰ 'ਤੇ ਆਉਂਦਾ ਹੈ ਉਸ ਨੂੰ ਥਾਰ ਗੱਡੀ ਵੀ ਦਿੱਤੀ ਜਾਂਦੀ ਹੈ ਇਹ ਟੂਰਨਾਮੈਂਟ ਸਾਲ 'ਚ ਸਿਰਫ ਇੱਕ ਵਾਰੀ ਹੁੰਦਾ ਹੈ ਇਹ ਗੇਮ ਬਹੁਤ ਹੀ ਵਧੀਆ ਹੈ ਅਤੇ ਬੰਦਾ ਫਰੀ ਟਾਈਮ ਵਿਹਲੇ ਟਾਈਮ ਬਹਿ ਕੇ ਇਸਨੂੰ ਖੇਡ ਸਕਦਾ ਹੈ ਇਹ ਗੇਮ ਦੀ ਰੁਚੀ ਸਿਰਫ ਉਹ ਲੋਕ ਈ ਰੱਖਣ ਜੋ ਕਿ ਦਿਨ 'ਚ ਇੱਕ ਇੱਕ ਅੱਧੇ ਘੰਟੇ ਦਾ ਸਮਾਂ ਨਿਕਾਲ ਸਕਦੇ ਹਨ ਹਰ ਕੋਈ ਬੰਦਾ ਇਸ ਗੇਮ ਨੂੰ ਨਹੀਂ ਖੇਡ ਸਕਦਾ ਇਸ ਤੋਂ ਸਿੱਖਣ ਲਈ ਸਾਨੂੰ ਬਹੁਤ ਹੀ ਟਾਈਮ ਲੱਗ ਜਾਂਦਾ ਹੈ ਪਰ ਇਹ ਚ ਬੰਦਾ ਸਿੱਖ ਜਾਂਦਾ ਹੈ ਤਾਂ ਉਹ ਆਪਣੇ ਆਪ ਦੀ ਕਮਾਈ ਵੀ ਕਰ ਸਕਦਾ ਹੈ ਧੰਨਵਾਦ